ਹਾਂਜੀ ਜੀ ਸਾਨੂੰ ਪਾਣੀ ਸਪਲਾਈ ਪੂਰੀ ਮਿਲਦੀ ਹੈ ਅਸੀਂ ਉਸ ਪ੍ਰਦੇਸ਼ ਦੇ ਵਾਸੀ ਹਾਂ ਜਿੱਥੇ ਪਾਣੀ ਦੀ ਕੋਈ ਕਮੀ ਨਹੀਂ ਇਹਨੂੰ ਪਾਣੀ ਦੇ ਕਾਰਨ ਹੀ ਤਾਂ ਪੰਜਾਬ ਕਿਹਾ ਜਾਂਦਾ ਹੈ ਐਥੇ ਚੌਵੀ ਘੰਟੇ ਪਾਣੀ ਦੀ ਉਪਲੱਬਧੀ ਹੈ ਤੁਸੀਂ ਜਦੋਂ ਵੀ ਆਪਣੀ ਟੂਟੀ ਜਿਹੀ ਓਨ ਕਰੋਗੇ ਚਲਾਓਗੇ ਪਾਣੀ ਉਸ ਵੇਲੇ ਤੁਹਾਡੇ ਬਰਤਣਾ ਵਿੱਚ ਪੈ ਜਾਊਗਾ ਪਰ ਮੈਂ ਕਈ ਇਹੋ ਜਿਹੀਆਂ ਜਗ੍ਹਾ ਵੀ ਵੇਖੀਆਂ ਹੈ ਜਿੱਥੇ ਪਾਣੀ ਦੀ ਬੜੀ ਕਿੱਲਤ ਹੈ ਮੈਂ ਆਪਣਾ ਖੁਦ ਦਾ ਤਜਰਬਾ ਦੱਸ ਰਿਹਾ ਮੈਂ ਪੰਜ ਪੰਜ ਕਿਲੋਮੀਟਰ ਦੂਰ ਪਾ ਪਾਣੀ ਦੀਆਂ ਪੰਜ ਪੰਜ ਲੀਟਰ ਦੀਆਂ ਕੇਨੀਆਂ ਭਰ ਕੇ ਹੈਂਡਪੰਪ ਤੋਂ ਲਿਆਉਂਦਾ ਰਿਹਾ ਆਪਣੇ ਘਰ ਪੀਣ ਲਈ ਧੋਣ ਲਈ ਕੱਪੜੇ ਧੋਣ ਲਈ ਅਤੇ ਪਾਣੀ ਉੱਥੇ ਬਿਲਕੁਲ ਵੀ ਮਿਲਦਾ ਨਹੀਂ ਹੈ ਪਰ ਚਲੋ ਕੋਈ ਨਹੀਂ ਅਸੀਂ ਰੱਬ ਦਾ ਸ਼ੁਕਰਾਨਾ ਕਰਦੇ ਹਾਂ ਕਿ ਅਸੀਂ ਉਸ ਧਰਤੀ 'ਤੇ ਜੰਮੇ ਹਾਂ ਜਿੱਥੇ ਪਾਣੀ ਦੀ ਕੋਈ ਕਮੀ ਨਹੀਂ ਹੈ ਸਾਰੀ ਸ ਅੱਧੇ ਹਿੰਦੁਸਤਾਨ ਵਿੱਚ ਪਾਣੀ ਪੰਜਾਬ ਦੇ ਥਰੂ ਹੀ ਜਾਂਦਾ ਹੈ ਪਰ ਜਦੋਂ ਪੰਜਾਬ 'ਚ ਪਾ ਹੜਾਂ ਦੇ ਹੀ ਮਾਰ ਵੀ ਪੰਜਾਬ ਹੀ ਝੇਲਦਾ ਹੈ ਜਦੋਂ ਹੜ ਆਉਂਦੇ ਹਨ ਤਾਂ ਸਭ ਤੋਂ ਜਿਆਦਾ ਨੁਕਸਾਨ ਪੰਜਾਬ ਦਾ ਹੀ ਹੁੰਦਾ ਹੈ